ਹੈਲੋ ਹਾਂਜੀ ਕਿਵੇਂ ਓਂ ਮੈਂ ਵੀ ਠੀਕ ਹਾਂ ਕੁਛ ਨਹੀਂ ਬਸ ਫਰੀ ਪਲੱਸ ਟੂ ਤੋਂ ਬਾਅਦ ਹਾਂਜੀ ਹਾਂਜੀ ਤੁਹਾਨੂੰ ਵੀ ਅੱਛਾ ਅੱਛਾ ਵਧੀਆ ਰਿਹਾ ਫਿਰ ਕੀ ਸੋਚਿਆ ਕਿੱਥੇ ਐਡਮਿਸ਼ਨ ਕਰਾਉਣੀ ਆ ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵੀ ਨੇੜੇ ਹੀ ਆ ਆਪਾਂ ਨੂੰ ਹਾਂਜੀ ਹਾਂਜੀ ਉਹ ਵੀ ਠੀਕ ਹੈ ਅਤੇ ਉਹ ਕਿੱਥੇ ਪੈ ਜਾਂਦੀ ਪੰਜਾਬੀ ਯੂਨੀਵਰਸਿਟੀ ਆਪਾਂ ਨੂੰ ਅੱਛਾ ਅੱਛਾ ਪਟਿਆਲੇ ਤਾਂ ਵੈਸੇ ਮੇਰੇ ਨਾਨਕੇ ਵੀ ਆ ਉੱਥੇ ਦੇਖ ਲੈਂਦੇ ਹਾਂ ਇੱਕ ਵਾਰ ਅੱਛਾ ਅੱਛਾ ਅੱਛਾ ਅੱਛਾ ਕਿੰਨਾਂ ਕੁ ਖਰਚਾ ਆ ਜਾਂਦਾ ਵੈਸੇ ਅੱਛਾ ਅੱਗੇ ਫਿਰ ਐਡਮੀਸ਼ਨ ਲੈ ਕੇ ਉਸ ਤੋਂ ਬਾਅਦ ਕਰਨਾ ਕੀ ਹੈ ਅੱਛਾ ਅੱਛਾ ਫੀਸ ਕਿੰਨੀ ਕੁ ਖਰਚਾ ਆਜੂਗਾ ਇਹਦੇ ਵਿੱਚ ਹਾਂਜੀ ਹਾਂਜੀ ਚਲੋ ਕੋਈ ਨਹੀਂ ਫਿਰ ਦੇਖਦੇ ਹਾਂ ਘਰ ਡਿਸਕਿਸ ਕਰ ਕੇ ਦੇਖ ਲੈਂਦੇ ਆ ਇਕ ਵਾਰ ਤੁਸੀਂ ਵੀ ਸਲਾਹ ਲੈ ਲਓ ਕੋਈ ਨਹੀਂ ਕੋਈ ਨਹੀਂ ਠੀਕ ਹੈ ਪੁੱਛ ਲੈਂਦੇ ਹਾਂ ਓਕੇ ਬਾਏ